ਖੇਡਾਂ ਸਾਡੇ ਸਮਾਜ ਵਿੱਚ ਇਸ ਲਈ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਕਈ ਤਾਂ ਆਪਣੇ ਮਨੋਰੰਜਨ ਲਈ ਖੇਡਦੇ ਹਨ ਕਈ ਜਿਵੇਂ ਕਿ ਬੱਚਿਆਂ ਨੂੰ ਚੁੱਪ ਕਰਵਾਉਣ ਲਈ ਕਈ ਤਾਂ ਬੱਚਿਆਂ ਨੂੰ ਬਹੁਤ ਖੇਡਾਂ ਪਸੰਦ ਹੁੰਦੀਆਂ ਹਨ ਜਿਵੇਂ ਕਿ ਕਬੱਡੀ ਖੋ ਖੋ ਵਗੈਰਾ ਇਸ ਲਈ ਅਸੀਂ ਖੇਡਾਂ ਖੇਡਦੇ ਹਾਂ ਕਈ ਜਿਵੇਂ ਕਿ ਆਪਣੀ ਨੌਕਰੀ ਲਈ ਖੇਡਾਂ ਖੇਡਦੇ ਹਨ ਜਿਵੇਂ ਕਿ ਫੌਜ ਲਈ ਪੁਲਿਸ ਲਈ ਕਈ ਆਪਣੇ ਮਨੋਰੰਜਨ ਲਈ ਖੇਡਾਂ ਖੇਡਦੇ ਹਨ ਕਈ ਸਕੂਲਾਂ ਵਿੱਚ ਵੀ ਖੇਡਾਂ ਖਿਡਾਈਆਂ ਜਾਂਦੀਆਂ ਹਨ ਜੋ ਬੱਚਿਆਂ ਦੇ ਸਰੀਰ ਲਈ ਵੀ ਠੀਕ ਹੁੰਦੀਆਂ ਹਨ ਅਤੇ ਬੱਚਿਆਂ ਲਈ ਜ਼ਰੂਰੀ ਵੀ ਹੁੰਦੀਆਂ ਹਨ ਇਹਨਾਂ ਦੇ ਨਾਲ ਹੀ ਬੱਚੇ ਅੱਗੇ ਵਧਦੇ ਹਨ ਕਈ ਘਰ ਵਿੱਚ ਵੀ ਖੇਡਾਂ ਖੇਡਦੇ ਹਨ ਜਿਵੇਂ ਕਿ ਆਪਣੇ ਸਰੀਰ ਨੂੰ ਫਿੱਟ ਰੱਖਣ ਲਈ ਅਤੇ ਕਈ ਬਿਮਾਰੀਆਂ ਤੋਂ ਦੂਰ ਕਰਨ ਲਈ ਵੀ ਖੇਡਾਂ ਖੇਡੀਆਂ ਜਾਂਦੀਆਂ ਹਨ ਕ੍ਰਿਕਟ ਵੀ ਸਾਡੇ ਭਾਰਤ ਦੀ ਫੇਮਸ ਫੇਮਸ ਖੇਡ ਹੈ ਜਿਸ ਨੂੰ ਆਮ ਤੌਰ 'ਤੇ ਖੇਡਿਆ ਜਾਂਦਾ ਹੈ